ਇੱਕ ਡਰਾਈਵਰ ਸੀ ਮੇਰਾ ਸਤਿਗੁਰੂ ਜੀ ਟੈਕਸੀ ਸਰਵਿਸ ਦਾ ਕੰਮ ਹੈ ਅਤੇ ਏਸ਼ੀਅਨ ਪੇਂਟ ਕੰਪਨੀ ਦੇ ਵਿੱਚ ਮੇਰਾ ਟੈਂਡਰ ਸੀ ਤਕਰੀਬਨ ਇੱਕ ਸਾਲ ਦਾ ਏਅਰਪੋਰਟ ਤੋਂ ਅਸੀਂ ਪਿੱਕ ਡਰੋਪ ਦਾ ਕੰਮ ਕਰਦੇ ਸੀ ਉਨ੍ਹਾਂ ਦੇ ਜਿਹੜੇ ਬਾਹਰ ਤੋਂ ਕਲਾਇਟ ਆਉਂਦੇ ਸੀ ਜਾਂ ਬਾਹਰ ਤੋਂ ਉਸਦੇ ਅਫਸਰ ਆਉਂਦੇ ਸੀ ਉਹਨਾਂ ਨੂੰ ਅਸੀਂ ਏਸ਼ੀਅਨ ਪੇਂਟ ਛੱਡਣਾ ਹੁੰਦਾ ਸੀ ਉਹ ਕੰਮ ਮੈਨੂੰ ਮਿਲਿਆ ਇੱਕ ਸਾਲ ਵਾਸਤੇ ਉਸਦੇ ਵਿੱਚ ਇੱਕ ਮੇਰੇ ਕੋਲ ਗੁਰਤੇਜ਼ ਨਾਮ ਦਾ ਇੱਕ ਡਰਾਈਵਰ ਸੀ ਜਿਹੜਾ ਕੀ ਬੜਾ ਰੂਡ ਬੀਹੇਵੀਅਰ ਦਾ ਅਤੇ ਜਿਹੜੇ ਕਸਟਮਰ ਆਉਂਦੇ ਸੀ ਜਾਂ ਉਨ੍ਹਾਂ ਦੇ ਕਲਾਈਂਟ ਲਾ ਲਓ ਏਸ਼ੀਅਨ ਪੇਂਟ ਵਾਲਿਆ ਦੇ ਜਾਂ ਸਾਡੀਆਂ ਸਵਾਰੀਆਂ ਲਾ ਲਓ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਰਸਤੇ 'ਚ ਗੱਡੀ ਰੋਕ ਲੈਂਦਾ ਸੀ ਅੱਠ ਕਿਲੋ ਮੀਟਰ ਦਾ ਸਾਰਾ ਰੰਨਵੇ ਸੀ ਅੱਠ ਕਿਲੋਮੀਟਰ 'ਤੇ ਛੱਡਣਾ ਹੁੰਦਾ ਸੀ ਅਤੇ ਉਹ ਦੋ ਦੋ ਤਿੰਨ ਤਿੰਨ ਘੰਟੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਦੇ ਪੈਸੇ ਕਦੇ ਕੁਝ ਉਹ ਇੱਕ ਸਾਲ ਮੇਰੇ ਲਈ ਐਡਾ ਟੈਂਡਰ ਪੂਰਾ ਕਰਨ ਦਾ ਐਡਾ ਮੇਰੀ ਸਿਰਦਰਦੀ ਬਣਿਆ ਜਦੋਂ ਇੱਕ ਸਾਲ ਪੂਰਾ ਹੋਇਆ ਤਾਂ ਮੈਂ ਉਹਦਾ ਧੰਨਵਾਦ ਕਰਕੇ ਉਹਦੀ ਸਾਰੀ ਪੇਅਮੈਂਟ ਕਰਕੇ ਉਹ ਤੋਂ ਆਪਣਾ ਖਹਿੜਾ ਛੁਡਾਇਆ